ਸਤਿ ਸ਼੍ਰੀ ਅਕਾਲ ਜੀ ਮੈਂ ਭਾਵਿਕਾ ਜਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਅੱਜ ਮੈਂ ਤੁਹਾਨੂੰ ਭਾਰਤੀ ਆਵਾਜਾਈ ਪ੍ਰਣਾਲੀ ਦੇ ਬਾਰੇ ਦੱਸਾਂਗੀ ਸਾਡੇ ਭਾਰਤ ਵਿੱਚ ਆਵਾਜਾਈ ਲਈ ਬਹੁਤ ਹੀ ਸਾਰੇ ਸਾਧਨ ਉਪਲੱਬਧ ਹਨ ਜਿਵੇਂ ਬਸ ਟਰੇਨ ਕਾਰ ਸਕੂਟਰ ਮੋਟਰਸਾਈਕਲ ਅੱਜ ਕੱਲ੍ਹ ਤਾਂ ਮੈਟਰੋ ਅਤੇ ਇਲੈਕਟਰਿਕ ਆਟੋ ਰਿਕਸ਼ਾ ਇਲੈਕਟਰਿਕ ਬਸਿਜ਼ ਵੀ ਉਪਲੱਬਧ ਹਨ ਲੋਕ ਆਪਣੀ ਆਪਣੀ ਲੋੜ ਅਨੁਸਾਰ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ ਵੈਸੇ ਤਾਂ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸਾਰੇ ਹੀ ਲੋਕਾਂ ਕੋਲ ਆਪਣੇ ਆਪਣੇ ਸਾਧਨ ਹਨ ਕਿਉਂਕਿ ਬਸ ਜਾਂ ਟਰੇਨ ਲੇਟ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਲੋਕ ਆਪਣੇ ਸਾਧਨ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ ਤਾਂ ਕਿ ਉਹਨਾਂ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਧੰਨਵਾਦ